ਵੈਸੇ ਤਾਂ ਦੇਖਿਆ ਜਾਵੇ ਤਾਂ ਬਹੁਤ ਸਾਰੇ ਢੰਗ ਹੈਗੇ ਹਨ ਜਿਸ ਵਿੱਚ ਆਪਣੇ ਬਜ਼ੁਰਗ ਮੰਜੇ 'ਤੇ ਪੈ ਜਾਂਦੇ ਹਨ ਉਹਨਾਂ ਵਿੱਚੋਂ ਕਈ ਢੰਗ ਇਹੋ ਜਿਹੇ ਹਨ ਜਿਸ ਵਿੱਚ ਮ ਬਜ਼ੁਰਗਾਂ ਨੂੰ ਮੋਤੀਆਬਿੰਦ ਹੋਣ ਦੀ ਪ੍ਰੋਬਲਮ ਸਮੱਸਿਆ ਹੋ ਜਾਂਦੀ ਹੈ ਅਤੇ ਮੋਤੀਆਬਿੰਦ ਦੇ ਨਾਲ਼ ਕਈ ਹੋਰ ਸਮੱਸਿਆ ਵੀ ਹਨ ਜਿਵੇਂ ਕਿ ਉਹਨਾਂ ਦਾ ਜੋੜਾਂ ਦਾ ਦਰਦ ਹੋ ਗਿਆ ਮੋ ਲੱਤਾਂ ਦਾ ਪ੍ਰੋਬਲਮ ਹੋ ਗਈ ਉਨ੍ਹਾਂ ਦੇ ਲੱਤਿਆ ਲੱਤਾਂ ਦੀ ਸਮੱਸਿਆਵਾਂ ਹੋ ਗਈਆਂ ਉਹਨਾਂ ਦੇ ਕੋਈ ਪੇਟ ਦੇ ਵਿੱਚ ਪ੍ਰੋਬਲਮ ਹੋ ਗਈ ਕੋਈ ਛਾਤੀ 'ਚ ਹੋ ਗਈ ਅੱਖਾਂ 'ਚ ਹੋ ਗਈ ਸਿਰ 'ਚ ਹੋ ਗਈ ਅਤੇ ਆਪਾਂ ਨੇ ਜਦੋਂ ਆਪਣੇ ਬਜ਼ੁਰਗ ਫਿਰ ਇਹੋ ਜਿਹੀਆਂ ਸਮੱਸਿਆ ਦੇਖ ਕੇ ਅਗਰ ਉਹਨਾਂ ਦੇ ਜੋੜਾਂ 'ਚ ਦਰਦ ਹੁੰਦਾ ਰਹਿੰਦਾ ਹੈ ਤਾਂ ਉਹ ਘੁੰਮਣ ਫਿਰਨਾ ਵੀ ਬਹੁਤ ਹੀ ਘੱਟ ਪਸੰਦ ਕਰਦੇ ਹਨ ਜਿਸ ਵਿੱਚ ਉਹ ਜ਼ਿਆਦਾਤਰ ਅਗਰ ਉਹ ਮੰਜੇ 'ਤੇ ਹੁੰਦੇ ਹਨ ਤਾਂ ਅਸੀਂ ਉਹਨਾਂ ਦੀ ਖੁਦ ਦੇਖਭਾਲ ਸਾਂਭ ਸੰਭਾਲ ਕਰਦੇ ਹਨ ਅਤੇ ਕਰਦੇ ਹਾਂ ਅਤੇ ਉਹਨਾਂ ਦਾ ਧਿਆਨ ਰੱਖਦੇ ਹਾਂ ਉਹਨਾਂ ਦੀ ਰੋਟੀ ਪਾਣੀ ਦਾ ਸਾਫ਼ ਸਫਾਈ ਦਾ ਧਿਆਨ ਰੱਖਦੇ ਹਾਂ ਜਿਸ ਦੇ ਕਾਰਨ ਉਹਨਾਂ ਨੂੰ ਵੀ ਬਹੁਤ ਵਧੀਆ ਫ਼ੀਲ ਹੁੰਦਾ ਹੈ ਕਿਉਂਕਿ ਅਸੀਂ ਅੱਜ ਦੇ ਟਾਈਮ ਅਗਰ ਗੱਲ ਕੀਤੀ ਜਾਵੇ ਤਾਂ ਜੋ ਬਜ਼ੁਰਗ ਸਾਨੂੰ ਪਾਲ ਪੋਸ਼ ਕੇ ਬੜਾ ਕਰਦੇ ਹਨ ਤਾਂ ਅਸੀਂ ਵੀ ਅੱਗੇ ਸਾਡਾ ਫ਼ਰਜ਼ ਬਣਦਾ ਹੈ ਕਿ ਉਹਨਾਂ ਨੂੰ ਆਪਾਂ ਪਾਲ ਪੋਸ਼ ਕੇ ਉਹਨਾਂ ਦਾ ਧਿਆਨ ਰੱਖਣਾ ਹੈ ਅਤੇ ਅਗਰ ਆਪਾਂ ਗੱਲ ਕੀਤੀ ਜਾਵੇ ਬ ਮ ਅੱਜ ਦੇ ਟਾਈਮ ਦੀ ਬਿਮਾਰੀਆਂ ਦੀ ਅੱਜ ਦੇ ਟਾਈਮ ਦੇ ਵਿੱਚ ਜਦੋਂ ਜਿੰਨਾ ਜਿੰਨੀ ਉਮਰ ਬੀਤਦੀ ਜਾਂਦੀ ਹੈ ਉੱਨਾਂ ਉੱਨਾਂ ਉਮਰ ਦੇ ਨਾਲ਼ ਨਾਲ਼ ਬਜ਼ੁਰਗਾਂ ਨੂੰ ਬਿਮਾਰੀਆਂ ਵੱਧਦੀਆਂ ਜਾ ਰਹੀਆਂ ਹਨ ਓਕੇ